ਹਾਂ ਮੈਂ ਦੋ ਅਕਤੂਬਰ ਦੋ ਹਜ਼ਾਰ ਚੌਦਾਂ ਨੂੰ ਸੱਠ ਕਿੱਲੋਮੀਟਰ ਜੋ ਕਿ ਐੱਨ ਐੱਸ ਜੀ ਦਾ ਕਮਾਂਡੋ ਚੈਲੇਂਜ ਸੀ ਜਿਸਨੂੰ ਮੈਂ ਦੋੜਿਆ ਔਰ ਪੂਰਾ ਕੀਤਾ ਉਸ ਤੋਂ ਬਾਅਦ ਮੇਰੇ ਕੋਲ ਬਹੁਤ ਬੜਾ ਐਕਸਪੀਰੀਐਂਸ ਆ ਗਿਆ ਸੀ ਜਿਸ ਨਾਲ ਮੈਨੂੰ ਖ਼ੁਦ ਨੂੰ ਹੀ ਆਪਣੇ ਆਪ 'ਤੇ ਇੱਕ ਪਰਾਉਡ ਫੀਲ ਹੋਇਆ ਸ਼ਾਨਦਾਰ ਖੇਡ ਸੀ ਔਰ ਮੈਨੂੰ ਲੱਗਦਾ ਸੀ ਇਹ ਨਵੀਂ ਨਵੀਂ ਹੈ ਔਰ ਸੱਠ ਕਿੱਲੋਮੀਟਰ ਦੌੜਨਾ ਮੇਰੇ ਵਾਸਤੇ ਬੜੀ ਗੱਲ ਸੀ